ਜਦੋਂ ਲੋਕਡਾਊਨ ਹੋਇਆ ਤਾਂ ਉਸ ਸਮੇਂ ਸਾਰੇ ਰੈਸਟੋਰੈਂਟ ਸਾਰੇ ਹੋਟਲ ਵਗੈਰਾ ਬੰਦ ਹੋ ਗਏ ਸਨ ਅਤੇ ਉਸ ਸਮੇਂ ਜੇ ਸਾਨੂੰ ਕੋਈ ਚੀਜ਼ ਖਾਣ ਦੀ ਮਨ ਕਰਦਾ ਤਾਂ ਮੈਂ ਯੂਟੀਊਬ ਤੋਂ ਦੇਖ ਕੇ ਜਲੇਬੀਆਂ ਰਸਗੁੱਲੇ ਗੁਲਾਬ ਜਾਮੁਨ ਅਤੇ ਸਮੋਸੇ ਵਗੈਰਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੋ ਘਰ ਬਣਾਈਆਂ ਸਨ ਜੋ ਮੈਂ ਕਦੇ ਹਮੇਸ਼ਾ ਬਜ਼ਾਰਾਂ ਵਿੱਚੋਂ ਖਰੀਦਦੀ ਹੁੰਦੀ ਸੀ ਲੋਕਡਾਊਨ ਦੇ ਵਿੱਚ ਮੈਂ ਇੱਕ ਵਾਰੀ ਯੂਟੀਊਬ ਤੋਂ ਦੇਖ ਕੇ ਕੇਕ ਬਣਾਉਣੇ ਸ਼ੁਰੂ ਕੀਤੇ ਕੇਕ ਬਣਾ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਮੈਂ ਬੜਾ ਬਹੁ ਸਾਰੇ ਲੋਕਾਂ ਨੂੰ ਕੇਕ ਖਵਾਇਆ ਅਤੇ ਉਹਨਾਂ ਨੇ ਵੀ ਬੜੇ ਹੀ ਸਰਾਹੁਣਾ ਕੀਤੀ ਕਿ ਤੇਰੇ ਕੇਕ ਤਾਂ ਬਹੁਤ ਹੀ ਸਵਾਦ ਬਣੇ ਹੋਏ ਹਨ ਫਿਰ ਮੈਂ ਹੌਲੀ ਹੌਲੀ ਲੋਕਡਾਊਨ ਦੇ ਵਿੱਚ ਹੀ ਬੜੇ ਸਾਰੇ ਲੋਕਾਂ ਨੂੰ ਘਰ ਦੇ ਘਰ ਜਾ ਕੇ ਔਰਡਰ ਦਿੱਤੇ ਲਿੱਤੇ ਅਤੇ ਉਹਨਾਂ ਨੇ ਮੈਨੂੰ ਬਹੁਤ ਸਾਰੇ ਔਰਡਰ ਦਿੱਤੇ ਜਿਹਦੇ ਨਾਲ਼ ਮੈਂ ਘਰ ਵਿੱਚ ਬਹੁਤ ਸਾਰੇ ਕੇਕ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਉਸ ਟਾਈਮ ਦੇ ਉੱਤੇ ਮੈਂ ਕੇਕ ਬਣਾਉਣਾ ਜਦੋਂ ਸ਼ੁਰੂ ਕੀਤਾ ਪਹਿਲਾਂ ਮੈਂ ਸੋਚਿਆ ਨਹੀਂ ਸੀ ਕਿ ਮੈਂ ਇੰਨੇ ਵੱਡੇ ਪੱਧਰ ਦੇ ਉੱਤੇ ਕੇਕ ਬਣਾਉਣ ਦਾ ਕੰਮ ਕਰ ਸਕਦੀ ਹਾਂ ਮੈਂ ਬਹੁਤ ਸਾਰੇ ਕੇਕ ਬਣਾਏ ਅਤੇ ਲੋਕਾਂ ਨੇ ਵੀ ਬੜੇ ਸਾਰੇ ਕੇਕਾਂ ਨੂੰ ਘਰ ਦੇ ਕੇਕਾਂ ਨੂੰ ਖਾ ਕੇ ਉਹਨਾਂ ਨੂੰ ਬਹੁਤ ਹੀ ਮੇਰੀ ਸਰਾਹੁਣਾ ਕੀਤੀ ਫਿਰ ਮੈਂ ਇੱਕ ਆਪਣਾ ਫੇਸਬੁੱਕ ਦੇ ਉੱਤੇ ਪੇਜ ਨੂੰ ਸ਼ੇਅਰ ਕੀਤਾ ਜਿਸ ਵਿੱਚ ਮੈਂ ਬਹੁਤ ਅਲੱਗ ਤਰ੍ਹਾਂ ਦੇ ਹੌਲੀ ਹੌਲੀ ਕਰਕੇ ਮੈਂ ਕੇਕ ਬਣਾਉਣੇ ਸ਼ੁਰੂ ਕਰ ਦਿੱਤੇ ਅੱਜ ਉਹੀ ਕੇਕ ਡੈਜ਼ਰ ਗਾਰਡਨ ਦੇ ਨਾਮ ਦੇ ਉੱਤੇ ਬਹੁਤ ਸਾਰੇ ਮਸ਼ਹੂਰ ਹੋ ਗਏ ਮੈਂ ਉਹਨਾਂ ਕੇਕਾਂ ਦੇ ਨਾਲ਼ ਅੱਜ ਆਪਣਾ ਇੱਕ ਬਹੁਤ ਵੱਡਾ ਕੰਮ ਸ਼ੁਰੂ ਕਰ ਲਿਆ ਹੈ ਉਹਨਾਂ ਕੇਕਾਂ ਤੋਂ ਹੀ ਮੈਂ ਹੌਲੀ ਹੌਲੀ ਉਹਨਾਂ ਦੇ ਕੇਕਾਂ ਤੋਂ ਸਿੱਖ ਸਿੱਖ ਕੇ ਲੋਕਾਂ ਤੋਂ ਸਿੱਖ ਸਿੱਖ ਕੇ ਮੈਂ ਅੱਜ ਬਹੁਤ ਸਾਰੇ ਮੈਨੂੰ ਔਰਡਰ ਮਿਲਦੇ ਹਨ ਕਿਸੇ ਦਾ ਜਨਮਦਿਨ ਹੋਵੇ ਤਾਂ ਮੈਨੂੰ ਇੱਕ ਕੇਕਾਂ ਦਾ ਔਰਡਰ ਮਿਲ ਜਾਂਦਾ ਹੈ ਜਨਮ ਦਿਨਾਂ ਦੇ ਉੱਤੇ ਲੋਕ ਇੱਕ ਰਿਟਰਨ ਗਿਫ਼ਟ ਜਾਂ ਵਾਪਸੀ ਵੇਲੇ ਗਿਫ਼ਟ ਦਿੰਦੇ ਹਨ ਜਿਨ੍ਹਾਂ ਦੇ ਨਾਲ਼ ਉਹਨਾਂ ਦੇ ਬੱਚਿਆਂ ਨੂੰ ਇੱਕ ਤਾਂ ਛੋਟੇ ਛੋਟੇ ਉਹਨਾਂ ਦੇ ਜੋ ਪਸੰਦ ਕਰਦੇ ਹਨ ਕਿ ਜਿੱਦਾਂ ਕਾਰਟੂਨ ਬਣਾਇਆ ਹੋਵੇ ਕੇਕ ਦੇ ਉੱਤੇ ਅਤੇ ਉਹਨਾਂ ਦੀ ਪਸੰਦ ਦਾ ਮੈਂ ਕੇਕ ਬਣਾਉਂਦੀ ਹਨ ਅਤੇ ਬੱਚੇ ਵੀ ਬੜੇ ਹੀ ਖੁਸ਼ ਹੁੰਦੇ ਹਨ ਲੋਕਡਾਊਨ ਵਿੱਚ ਸਿੱਖਿਆ ਹੋਇਆ ਕੰਮ ਲੋਕਡਾਊਨ ਵਿੱਚ ਕੀਤਾ ਹੋਇਆ ਕੰਮ ਅੱਜ ਮੇਰਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੋ ਗਿਆ ਹਨ ਅੱਜ ਲੋਕ ਮੇਰਾ ਇੱਕ ਨਾਮ ਸ਼ਹਿਰ ਵਿੱਚ ਪੂਰੇ ਚੱਲਦਾ ਹੈ ਜਿਹਦੇ ਨਾਲ਼ ਕਿ ਮੈਂ ਬਹੁਤ ਮਸ਼ਹੂਰ ਹੋ ਗਈ ਹਨ ਲੋਕਡਾਊਨ ਦੇ ਵਿੱਚ ਬਹੁਤ ਸਾਰੀਆਂ ਜਨਾਨੀਆਂ ਨੇ ਇਹੋ ਜਿਹੇ ਕੰਮ ਸ਼ੁਰੂ ਕੀਤੇ ਅਤੇ ਇਹੋ ਜਿਹੇ ਕੰਮ ਵੀ ਕੀਤੇ ਜਿਨ੍ਹਾਂ ਨਾਲ਼ ਉਹ ਬਹੁਤ ਮਸ਼ਹੂਰ ਹੋਈਆਂ ਅਤੇ ਮੈਂ ਵੀ ਲੋਕਡਾਊਨ ਵਿੱਚ ਹਰ ਚੀਜ਼ ਘਰ ਬਣਾਈ ਜਿਹਦੇ ਨਾਲ਼ ਇੱਕ ਤਾਂ ਮੈਨੂੰ ਉਸ ਚੀਜ਼ ਨੂੰ ਬਣਾਉਣ ਦਾ ਪਤਾ ਲੱਗਾ ਅਤੇ ਦੂਸਰਾ ਮੈਂ ਉਸ ਚੀਜ਼ਾਂ ਦੇ ਨਾਲ਼ ਮੇਰਾ ਇੱਕ ਨਾਮ ਹੋ ਗਿਆ ਹੈ